ਹੈਲੋ ਸਤਿ ਸ਼੍ਰੀ ਅਕਾਲ ਮੈਮ ਅਸੀਂ ਹੁਣ ਵਾਹਗਾ ਬੋਡਰ ਚੱਲ ਸਕਦੇ ਹਾਂ ਹਾਂਜੀ ਐਂਟਰੀ ਫੀਸ ਤਾਂ ਹੈਗੀ ਆ ਸੌ ਰੁਪਿਆ ਅਤੇ ਤੁਸੀਂ ਟਾਈਮਿੰਗ ਤੁਸੀਂ ਜਾਂ ਤਾਂ ਅਸੀਂ ਜਿੱਦਾਂ ਸਵੇਰੇ ਜਾ ਸਕਦੇ ਸੀਗੇ ਹੁਣ ਅਸੀਂ ਸ਼ਾਮ ਨੂੰ ਜਾ ਸਕਦੇ ਹਾਂ ਚਾਰ ਵਜੇ ਸ਼ਾਇਦ ਐਂਟਰੀ ਹੋ ਜਾਣੀ ਆ ਹਾਂਜੀ ਅਤੇ ਤੁਸੀਂ ਮੈਨੂੰ ਆਪਣਾ ਟਾਈਮ ਦੱਸ ਦਿਓ ਉਸ ਹਿਸਾਬ ਨਾਲ ਅਸੀਂ ਚਲ ਜਾਵਾਂਗੇ ਠੀਕ ਆ ਠੀਕ ਆ ਮੈਮ ਓਕੇ